ਹੈਲੋ ਸਰ ਮੈਂ ਤੁਹਾਡੇ ਡਿਲੀਵਰੀ ਵਾਲੇ ਆਦਮੀ ਬਾਰੇ ਸ਼ਿਕਾਇਤ ਕਰਨਾ ਚਾਹੁੰਦਾ ਹਾਂ ਕਿ ਜੋ ਸਾਡੇ ਘਰ ਔਡਰ ਦੇਣ ਆਇਆ ਸੀ ਉਸ ਦਾ ਵਤੀਰਾ ਸਹੀ ਨਹੀਂ ਸੀ ਅਸਲ ਵਿੱਚ ਮੈਂ ਆਪਣੇ ਘਰ ਛੋਟੀ ਜਿਹੀ ਪਾਰਟੀ ਰੱਖੀ ਸੀ ਅਤੇ ਮੈਂ ਖਾਣਾ ਔਡਰ ਕੀਤਾ ਸੀ ਇੱਕ ਤਾਂ ਉਹ ਦੇਰ ਨਾਲ ਆਇਆ ਜੇ ਆਇਆ ਤਾਂ ਉਹ ਘਰ ਤੋਂ ਕਿੰਨੀ ਦੂਰ ਖੜ੍ਹਾ ਹੋ ਕੇ ਫੋਨ ਕਰਨ ਲੱਗ ਪਿਆ ਕਿ ਇੱਥੇ ਆ ਕੇ ਸਮਾਨ ਲੈ ਜਾਓ ਮੇਰੇ ਵਾਰ ਵਾਰ ਕਹਿਣ 'ਤੇ ਜੇ ਉਹ ਘਰ ਆਇਆ ਤਾਂ ਉਸ ਦਾ ਵਰਤਾਉ ਬੜਾ ਅਸ਼ਲੀਲ ਸੀ ਉਸਨੇ ਬੋਲਣ ਦਾ ਵੇਖਣ ਦਾ ਢੰਗ ਸਹੀ ਨਹੀਂ ਸੀ ਜਦੋਂ ਮੈਂ ਸਮਾਨ ਫੜਿਆ ਤਾਂ ਉਸਨੇ ਮੇਰੇ ਵੱਲ ਅਜੀਬ ਢੰਗ ਨਾਲ ਵੇਖਿਆ ਜੋ ਮੈਨੂੰ ਸਹੀ ਨਹੀਂ ਲੱਗਿਆ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਇਸ ਨੂੰ ਨਾ ਭੇਜਿਆ ਜਾਵੇ ਧੰਨਵਾਦ